ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਨੀਲਮ ਗੱਲ ਕਰ ਰਹੀ ਹਾਂ ਜੀ ਮੈਂ ਬੁੱਕ ਕੀਤੀ ਸੀ ਕੈਬ ਹਾਂਜੀ ਚੰਡੀਗੜ੍ਹ ਏਅਰਪੋਰਟ 'ਤੇ ਜਾਣ ਲਈ ਮੈਂ ਤੁਹਾਡੇ ਕੋਲ ਟਾਈਮ ਦਾ ਹੀ ਕਨਫਰਮ ਕਰਨਾ ਸੀ ਵੀ ਤੁਸੀਂ ਕਿੰਨੇ ਵਜੇ ਆਉਂਗੇ ਕਿਉਂਕਿ ਟਰੈਫਿਕ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਇਸ ਕਰਕੇ ਪਲੀਸ ਦੱਸਿਆ ਜਾਵੇ ਵੀ ਤੁਸੀਂ ਕਿੰਨੇ ਕੁ ਵਜੇ ਤੱਕ ਇੱਥੇ ਪਹੁੰਚ ਸਕਦੇ ਹੋ ਕਿਉਂਕਿ ਫਤਿਹਗੜ੍ਹ ਸਾਹਿਬ ਜਾਣਾ ਫਤਿਹਗੜ੍ਹ ਸਾਹਿਬ ਤੋਂ ਬਾਅਦ ਮੈਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਮੱਥਾ ਵੀ ਟੇਕਣਾ ਚਾਹੁੰਦੀ ਹਾਂ ਅਤੇ ਉਸ ਤੋਂ ਬਾਅਦ ਫਿਰ ਮੈਂ ਜਾਂਦੇ ਹੋਏ ਰਸਤੇ ਵਿੱਚ ਸੋਹਾਣਾ ਸਾਹਿਬ ਵੀ ਮੱਥਾ ਟੇਕਣਾ ਆ ਜੇ ਤੁਸੀਂ ਟਾਈਮ ਸਿਰ ਪਹੁੰਚ ਜਾਓਗੇ ਤਾਂ ਜ਼ਿਆਦਾ ਵਧੀਆ ਆ ਹਾਂਜੀ ਕਿੰਨੇ ਕੁ ਵਜੇ ਤੱਕ ਤੁਸੀਂ ਪਹੁੰਚ ਸਕਦੇ ਹੋ ਕੁਛ ਆਈਡੀਆ ਜੇ ਦੱਸ ਦੋਂਗੇ ਤਾਂ ਜ਼ਿਆਦਾ ਹੀ ਵਧੀਆ ਆ ਕਿਉਂਕਿ ਟਰੈਫਿਕ ਬਹੁਤ ਜ਼ਿਆਦਾ ਆ ਕੁਛ ਮੌਸਮ ਵੀ ਐਨਾ ਖਰਾਬ ਹੋਇਆ ਪਿਆ ਬਾਰਿਸ਼ ਹੋ ਰਹੀ ਆ ਲਗਾਤਾਰ ਅਤੇ ਬਾਰਿਸ਼ ਦੀ ਵਜ੍ਹਾ ਨਾਲ ਵੈਸੇ ਅੱਧਾ ਪੌਣਾ ਘੰਟਾ ਡਿਲੇਅ ਹੋ ਜਾਣਾ ਅਤੇ ਮੇਰੀ ਫਲਾਈਟ ਦਾ ਟਾਈਮ ਵੀ ਫਿਕਸ ਆ ਕੱਲ੍ਹ ਸਵਾ ਗਿਆਰ੍ਹਾਂ ਅਤੇ ਤੁਸੀਂ ਹੋ ਸਕੋਂਗੇ ਤਾਂ ਸਾਢੇ ਅੱਠ ਨੌ ਵਜੇ ਦੇ ਵਿੱਚ ਵਿੱਚ ਪਹੁੰਚ ਜਾਓਗੇ ਤਾਂ ਜ਼ਿਆਦਾ ਹੀ ਵਧੀਆ ਆ ਕਿਉਂਕਿ ਮੇਰਾ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੇਰੀ ਸ਼ਾਮ ਨੂੰ ਹੈਗੀ ਮੀਟਿੰਗ ਇਸ ਕਰਕੇ ਮੈਂ ਟ ਮੈਂ ਟਾਈਮ ਸਿਰ ਪਹੁੰਚਣਾ ਚਾਹੁੰਦੀ ਹਾਂ ਅਤੇ ਕਿਰਪਾ ਕਰਕੇ ਪਲੀਜ਼ ਵੀਰ ਜੀ ਆਪਣਾ ਟਾਈਮ ਸਿਰ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਮੈਂ ਵੀ ਅੱਗੇ ਜਾ ਕੇ ਆਪਣਾ ਸਹੀ ਟਾਈਮ 'ਤੇ ਪਹੁੰਚ ਸਕਾਂ ਹਾਂਜੀ ਇਸ ਕਰਕੇ ਤੁਹਾਡਾ ਧੰਨਵਾਦ